ਅਸੀਂ ਘਰ ਵਿੱਚ ਬਹੁਤ ਸਾਰੇ ਪਕਵਾਨ ਤਿਆਰ ਕਰ ਸਕਦੇ ਹਾਂ ਜਿਵੇਂ ਕਿ ਹੁਣ ਦਾ ਸਮਾਂ ਹੈ ਕਿ ਆਪਾਂ ਹਰ ਚੀਜ਼ ਸਿੱਖ ਕੇ ਆਪਣੇ ਘਰ ਬਣਾ ਸਕਦੇ ਹਾਂ ਬਜ਼ਾਰੋਂ ਖਰੀਦਣ ਦੀ ਲੋੜ ਹੀ ਨਹੀਂ ਪੈਂਦੀ ਇਸ ਤਰ੍ਹਾਂ ਆਪਾਂ ਘਰ ਵਿੱਚ ਪਨੀਰ ਪਕੌੜੇ ਆਲੂ ਪਕੌੜੇ ਗੋਭੀ ਵਾਲੇ ਪਕੌੜੇ ਪਾਲਕ ਪਕੌੜੇ ਆਦਿ ਪਕੌੜੇ ਤਿਆਰ ਕਰ ਸਕਦੇ ਹਾਂ ਅਤੇ ਅਸੀਂ ਘਰ ਵਿੱਚ ਛੋਲੇ ਪੂੜੀਆਂ ਪੀਜ਼ਾ ਬਰਗਰ ਨਿਊਡਲ ਮੈਗੀ ਬਹੁਤ ਸਾਰੀਆਂ ਚੀਜ਼ਾਂ ਨੂੰ ਘਰ ਹੀ ਤਿਆਰ ਕਰਕੇ ਕਰ ਲੈਂਦੇ ਹਾਂ ਅਤੇ ਹੁਣ ਜਿਵੇਂ ਕਿ ਮਤਲਬ ਇਹ ਸਾਰੇ ਵਿਅੰਜਨ ਅਸੀਂ ਤਿਆਰ ਕਰਦੇ ਆ ਇਹਨਾਂ ਸਾਰਿਆਂ ਦੇ ਨਾਲ ਚਟਨੀ ਦੀ ਅਤੇ ਲੋੜ ਪੈਂਦੀ ਪੈਂਦੀ ਹੈ ਅਤੇ ਅਸੀਂ ਚਟਨੀ ਵੀ ਖੁਦ ਘਰ ਤਿਆਰ ਕਰ ਲੈਂਦੇ ਹਾਂ ਉਸ ਚਟਨੀ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਪਹਿਲਾਂ ਤਾਂ ਅਸੀਂ ਇਮਲੀ ਲੈਣੀ ਆ ਉਸ ਇਮਲੀ ਨੂੰ ਕੁਝ ਸਮੇਂ ਸ ਅਸੀਂ ਪਾਣੀ 'ਚ ਭਿਉਂ ਕੇ ਰੱਖਣਾ ਉਹਨੂੰ ਭਿਉਂਣ ਤੋਂ ਬਾਅਦ ਉਹਨੂੰ ਗੈਸ ਅਤੇ ਰੱਖਣਾ ਅਤੇ ਕੁਝ ਸਮੇਂ ਲਈ ਉਹਨੂੰ ਉਬਲਣ ਦੇਣਾ ਜਦੋਂ ਉਹ ਇਮਲੀ ਉਬਲ ਰਹੀ ਹੋਏਗੀ ਤਾਂ ਉਸ ਵਿੱਚ ਅਸੀਂ ਆਪਣੀ ਮਰਜ਼ੀ ਦੇ ਮਸਾਲੇ ਪਾ ਸਕਦੇ ਹਾਂ ਜਿਵੇਂ ਕਿ ਨਮਕ ਕਾਲੀ ਮਿਰਚ ਅਤੇ ਦੇਗੀ ਮਿਰਚ ਆਦਿ ਅਤੇ ਫਿਰ ਉਸ ਤੋਂ ਬਾਅਦ ਆਪਣੀ ਮਨਪਸੰਦ ਦੇ ਮਸਾਲੇ ਪਾਉਣ ਤੋਂ ਬਾਅਦ ਅਸੀਂ ਉਸਨੂੰ ਚੰਗੀ ਤਰ੍ਹਾਂ ਉਬਲਣ ਦੇਣਾ ਅਤੇ ਉਬਲਣ ਤੋਂ ਬਾਅਦ ਉਸਨੂੰ ਅਸੀਂ ਉੱਥੇ ਕਿਸੇ ਵੀ ਬਰਤਨ ਦੇ ਵਿੱਚ ਪਾਉਣਾ ਅਤੇ ਸਾਡੀ ਚਟਨੀ ਤਿਆਰ ਹੋ ਜਾਏਗੀ ਅਤੇ ਜਦੋਂ ਅਸੀਂ ਇਹ ਚਟਨੀ ਬਣਾਉਂਦੇ ਇੰਨੀ ਕੁ ਸਵਾਦ ਬਣਦੀ ਹੈ ਕਿ ਜਦੋਂ ਕੋਈ ਵੀ ਖਾਂਦਾ ਤਾਂ ਉਹ ਤਾਰੀਫਾਂ ਹੀ ਕਰਦਾ ਰਹਿ ਜਾਂਦਾ ਹੈ